ਮੈਂ ਵਰਿੰਦਰ ਕੁਮਾਰ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਸੁਜਾਨਪੁਰ ਸ਼ਹਿਰ ਤੋਂ ਇੱਕ ਪੰਜ ਦੋ ਹਜ਼ਾਰ ਚੌਵੀ ਨੂੰ ਛੇ ਵਜੇ ਸੁਜਾਨਪੁਰ ਤੋਂ ਚੰਡੀਗੜ੍ਹ ਲਈ ਰਵਾਨਾ ਹੋਣਾ ਹੈ ਮੈਨੂੰ ਮੇਰੇ ਦੋਸਤਾਂ ਤੋਂ ਪਤਾ ਲੱਗਿਆ ਕਿ ਸੇਵਾ ਟਰੈਵਲ ਏਜੰਸੀ ਸੁਜਾਨਪੁਰ ਯਾਤਰੀਆਂ ਦੀ ਸਹੂਲਤ ਲਈ ਬੜੀ ਸੋਹਣੀ ਟੈਕਸੀ ਪ੍ਰਦਾਨ ਕਰਦੀ ਹੈ ਮੈਂ ਉਹਨਾਂ ਤੋਂ ਨੰਬਰ ਲੈ ਕੇ ਸੇਵਾ ਟਰੈਵਲ ਏਜੰਸੀ ਨੂੰ ਫੋਨ ਲਗਾਇਆ ਅਤੇ ਕਿਹਾ ਕਿ ਮੈਂ ਇੱਕ ਪੰਜ ਚੌਵੀ ਨੂੰ ਛੇ ਵਜੇ ਚੰਡੀਗੜ੍ਹ ਲਈ ਰਵਾਨਾ ਹੋਣਾ ਹੈ ਉਹਨਾਂ ਨੇ ਮੈਨੂੰ ਇਹ ਭਰੋਸਾ ਦਿੱਤਾ ਕਿ ਤੁਹਾਡੇ ਕੋਲ ਉਸ ਤਰੀਕ ਨੂੰ ਅੱਧਾ ਘੰਟਾ ਪਹਿਲਾਂ ਟੈਕਸੀ ਪਹੁੰਚ ਜਾਵੇਗੀ ਉਹਨਾਂ ਦੀ ਟੈਕਸੀ ਕਰਨ ਤੋਂ ਬਾਅਦ ਮੇਰੇ ਮਨ ਦੀ ਸਾਰੀ ਸੋਚ ਦੂਰ ਹੋ ਗਈ ਕਿ ਮੈਂ ਸਮੇਂ ਸਿਰ ਉੱਥੇ ਪਹੁੰਚ ਜਾਵਾਂਗਾ ਕਿਉਂਕਿ ਚੰਡੀਗੜ੍ਹ ਮੇਰੀ ਨੌਕਰੀ ਦੀ ਇੰਟਰਵਿਊ ਸੀ ਮੈਂ ਉਹਨਾਂ ਸ਼ਿਵਾ ਟਰੈਵਲ ਏਜੰਸੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਇਸ ਮੁਸ਼ਕਲ ਨੂੰ ਇੰਨਾ ਆਸਾਨ ਕਰ ਦਿੱਤਾ ਕਿ ਹੁਣ ਮੈਂ ਉਸ ਦਿਨ ਦੀ ਕੋਈ ਚਿੰਤਾ ਨਹੀਂ ਹੈ ਮੈਂ ਸ਼ਿਵਾ ਟਰੈਵਲ ਵਾਲਿਆਂ ਨੂੰ ਬੇਨਤੀ ਕੀਤੀ ਕਿ ਮੈਨੂੰ ਔਨਲਾਈਨ ਔਨਲਾਈਨ ਟਿਕਟ ਭੇਜੀ ਭੇਜ ਦਿੱਤੀ ਜਾਵੇ ਉਹਨਾਂ ਨੇ ਮੈਨੂੰ ਇਹ ਟਿਕਟ ਔਨਲਾਈਨ ਭੇਜ ਦਿੱਤੀ ਅਤੇ ਹੁਣ ਮੈਨੂੰ ਉਸ ਦਿਨ ਦੀ ਲਈ ਜਦੋਂ ਚੰ ਮੈਂ ਚੰਡੀਗੜ੍ਹ ਜਾਣਾ ਹੈ ਮੇਰੇ ਮਨ ਵਿੱਚ ਕੋਈ ਚਿੰਤਾ ਨਹੀਂ ਕਿ ਮੈਂ ਆਸ ਕਰਦਾ ਹਾਂ ਕਿ ਜੇਕਰ ਮੇਰੇ ਕਿਸੇ ਸਾਥੀ ਨੂੰ ਕਿਤੇ ਜਾਣਾ ਹੈ ਹੋਵੇ ਤਾਂ ਉਹ ਵੀ ਇਸ ਟੈਕਸੀ ਸਟੈਂਡ ਤੋਂ ਟੈਕਸੀ ਵਗੈਰਾ ਲੈ ਸਕਦਾ ਹੈ ਮੈਂ ਆਪਣੇ ਟਿਕਾਣੇ 'ਤੇ ਸਮੇਂ ਸਿਰ ਪੁੱਜ ਸਕਦਾ ਹਾਂ ਧੰਨਵਾਦ